ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਪਰਿਵਾਨ ਸੇਵਾ ਕਰਕੇ ਸਾਡੇ ਵਰਗੇ ਨੌਕਰੀ ਪੇਸ਼ਾ ਬੰਦਿਆਂ ਵਾਸਤੇ ਤੁਸੀਂ ਜਿਹੜੀ ਮਦਦ ਸਾਡੀ ਕਰ ਰਹੇ ਹੋ ਕਿ ਸਾਨੂੰ ਨਹੀਂ ਤਾਂ ਟਾਈਮ ਕੱਢਣਾ ਪੈਂਦਾ ਸੀ ਆਪਣੇ ਨੌਕਰੀ ਤੋਂ ਛੁੱਟੀ ਲੈ ਕੇ ਹਾਫ ਡੇ ਲੈ ਕੇ ਜਾਣਾ ਪੈਂਦਾ ਸੀ ਸਰਕਾਰੀ ਦਫ਼ਤਰਾਂ ਵਿੱਚ ਅਤੇ ਉਸ ਤੋਂ ਜਾਣ ਤੋਂ ਅਸੀਂ ਬਚ ਜਾਂਦੇ ਹਾਂ ਹੁਣ ਅਸੀਂ ਓਨਲਾਈਨ ਆਪਣਾ ਕੰਮ ਕਰਵਾ ਸਕਦੇ ਹਾਂ ਹੁਣ ਈਮੇਲ ਲਿਖਣ ਨਾ ਮੇਰਾ ਜੋ ਮੁੱਖ ਕਾਰਨ ਉਹ ਇਹ ਹੈਗਾ ਕਿ ਮੈਂ ਪਿੱਛੇ ਜਿਹੇ ਇੱਕ ਸੈਕਿੰਡ ਹੈਂਡ ਗੱਡੀ ਲਈ ਸੀ ਅਤੇ ਜਿਵੇਂ ਕਿ ਹੁਣ ਗੱਡੀ ਲੈ ਕੇ ਆਪਾਂ ਨੂੰ ਰਜਿਸਟਰ ਕਰਵਾਉਣਾ ਪੈਂਦਾ ਅਤੇ ਮੈਂ ਓਨਲਾਈਨ ਕਰਵਾਵਾਉਣਾ ਚਾਅ ਰਿਹਾ ਸੀ ਕਾਫ਼ੀ ਹੱਦ ਤੱਕ ਤਾਂ ਮੈਂ ਉਹਦੇ 'ਚ ਐਪਲੀਕੇਸ਼ਨ ਭਰਤੀ ਪਰ ਹੁਣ ਜਦੋਂ ਮੁੜ ਕੇ ਪਹੁੰਚੇ ਹਾਂ ਆਪਾਂ ਇੱਕ ਸਲੋਟ ਬੁੱਕ ਕਰਨ ਵਾਸਤੇ ਤਾਂ ਉੱਥੇ ਮੈਂ ਜਿਹੜਾ ਲੋੜੀਂਦਾ ਸਲੋਟ ਚਾਹੂੰਦਾ ਹੋ ਮੈਨੂੰ ਨਹੀਂ ਮਿਲ ਪਾ ਰਿਹਾ ਕੁਛ ਮੈਂ ਸਮਝ ਵੀ ਨਹੀਂ ਪਾ ਰਿਹਾ ਕਿ ਕਿੱਦਾਂ ਇਹਨੂੰ ਕਰਾਂ ਕਿਉਂਕਿ ਕੁਛ ਉੱਥੇ ਲਾਈਨਾਂ ਲਿਖੀਆਂ ਸੀ ਜਿਹੜੀਆਂ ਕਿ ਮੈਨੂੰ ਸਮਝ ਹੀ ਨਹੀਂ ਆਈਆਂ ਅਤੇ ਮੈਂ ਇਸ ਈਮੇਲ ਰਾਹੀਂ ਇਹ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਕੋਈ ਐਸੀ ਯੂਟੀਊਬ 'ਤੇ ਵੀਡੀਓ ਜਾਂ ਕੋਈ ਵੀਡੀਓ ਭੇਜ ਦਿੱਤੀ ਜਾਵੇ ਤਾਂ ਜੋ ਮੈਂ ਸਮਝ ਪਾਵਾਂ ਕਿ ਓਨਲਾਈਨ ਐਪਲੀਕੇਸ਼ਨ ਪਾ ਕੇ ਮੈਂ ਸਲੋਟ ਕਿੱਦਾਂ ਬੁੱਕ ਕਰ ਸਕਦਾ ਆਪਣੀ ਗੱਡੀ ਦੀ ਰਜਿਸਟਰੇਸ਼ਨ ਕਰਵਾਉਣ ਵਾਸਤੇ